ਕਰੇਟੀਵ ਫੂਡ ਤੋਂ ਗੱਲ ਕਰ ਰਹੇ ਹੋ ਜੀ ਹਾਂਜੀ ਸਰ ਮੇਰਾ ਇੱਕ ਓਡਰ ਸੀਗਾ ਹਰਜਿੰਦਰ ਸੈਣੀ ਦੇ ਨਾਮ 'ਤੇ ਚਾਰ ਚਿਕਨ ਬਰਗਰ ਸੀਗੇ ਜੀ ਹਾਂਜੀ ਅਤੇ ਹਾਂਜੀ ਹਾਂਜੀ ਹਾਂਜੀ ਅਤੇ ਸਰ ਉਹਦੇ ਨਾਲ ਮੈਨੂੰ ਥੋੜ੍ਹਾ ਜਿਹਾ ਕੁਛ ਐਕਸਟਰਾ ਐਡ ਕਰਵਾਉਣਾ ਸੀਗਾ ਜੀ ਇੱਕ ਤਾਂ ਐਕਸਟਰਾ ਚੀਜ਼ ਪੁਆ ਚੀਜ਼ ਪੁਆਉਣੀ ਸੀਗੀ ਜੀ ਉਹਦੇ 'ਚ ਅਤੇ ਚਿੱਲੀ ਸੋਸ ਚਾਰ ਜਾਂ ਪੰਜ ਬਾਓਲ ਉਹਦੇ ਐਕਸਟਰਾ ਕਰ ਦਿਉ ਪਲੀਜ਼ ਹਾਂਜੀ ਅਤੇ ਅਗਰ ਇਹਦੇ ਕੁਝ ਚਾਰਜਿਸ ਹੈਗੇ ਹੈ ਤਾਂ ਉਹ ਬਿਲ 'ਚ ਐਡ ਕਰਕੇ ਮੇਰੇ ਐਡਰਸ 'ਤੇ ਡਿਲਵਰ ਕਰ ਦਿਉ ਠੀਕ ਹੈ ਜੀ ਓਕੇ ਥੈਂਕ ਯੂ